ਭੰਗੜਾ ਅਰੇਬਿਕਸ ਆਪਣੇ ਪ੍ਰਤੀਭਾਗੀਆਂ ਵਿੱਚ ਰਚਨਾਮਕਤਾ ਨੂੰ ਕਈ ਤਰੀਕਿਆਂ ਨਾਲ ਪ੍ਰੇਰਿਤ ਕਰਦਾ ਹੈ ਪਹਿਲੀ ਮੁਫ਼ਤ ਅਦਾਕਾਰੀ ਭੰਗੜਾ ਵਿੱਚ ਗਤੀਵਿਧੀਆਂ ਦੇ ਸੰਗੀਤ ਦੀਆਂ ਧੁੰਨਾਂ ਨੂੰ ਇੱਕ ਦੂਜੇ ਨਾਲ ਮਿਲਾਉਣ ਦੀ ਆਜ਼ਾਦੀ ਹੁੰਦੀ ਹੈ ਜਿਸ ਨਾਲ ਵਿਅਕਤੀਆਂ ਨੂੰ ਆਪਣੀ ਰਚਨਾਮਿਕਤਾ ਨੂੰ ਉਭਾਰਨ ਦਾ ਮੌਕਾ ਮਿਲਦਾ ਹੈ ਦੂਸਰਾ ਆਜ਼ਾਦੀ ਅਤੇ ਸ਼ੈਲੀ ਭੰਗੜਾ ਦੀਆਂ ਰਖ ਰਖਮਾਂ ਅਤੇ ਗਤੀਵਿਧੀਆਂ ਦੌਰਾਨ ਪ੍ਰਤਿਭਾਗੀ ਆਪਣੇ ਆਜ਼ਾਦੀ ਦੇ ਨਾਲ ਸ਼ੈਲੀ ਅਤੇ ਅਸਲਤਾ ਲੈ ਆਉਂਦਾ ਹੈ ਜਿਸ ਨਾਲ ਉਸ ਉਹ ਹੋਰ ਜ਼ਿਆਦਾ ਰਚਨਾਤਮਿਕਤਾ ਬਣਾਉਂਦੇ ਹਨ ਤੀਸਰਾ ਜਜ਼ਬਾ ਅਤੇ ਭਾਵਨਾ ਭੰਗੜਾ ਅਰੇਬਿਕਸ ਨਾਲ ਪ੍ਰਤਿਭਾਗੀ ਆਪਣੇ ਭਾਵਨਾਵਾਂ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਦੇ ਹਨ ਜਿਸ ਨਾਲ ਉਹ ਆਪਣੀ ਰਚਨਾਤਮਿਕਤਾ ਨੂੰ ਹੋਰ ਵਾਧਾ ਕਰਦੇ ਹਨ ਇਸ ਤਰ੍ਹਾਂ ਭੰਗੜਾ ਅਰੇਬਿਕਸ ਨਾਲ ਸਿਰਫ਼ ਇੱਕ ਸਰੀਰਿਕ ਕਸਰਤ ਹੈ ਸਗੋਂ ਉਹ ਪ੍ਰਤਿਭਾਗੀਆ ਨੂੰ ਆਪਣੇ ਮਨ ਅਤੇ ਸਰੀਰ ਵਿੱਚ ਖੋਜ ਕਰਨ ਅਤੇ ਨਵੀਆਂ ਸੋਚਾਂ ਨੂੰ ਜਨਮ ਦੇਣ ਦਾ ਮੌਕਾ ਦਿੰਦੇ ਹਨ